ਸਤਿ ਸ਼੍ਰੀ ਅਕਾਲ ਹਾਂਜੀ ਪ੍ਰੋਫੈਸਰ ਜਸਮੀਨ ਕੌਰ ਕਿਵੇਂ ਓਂ ਤੁਸੀਂ ਵਧੀਆ ਕਿਵੇਂ ਕਿੱਦਾਂ ਚੱਲ ਰਿਹਾ ਅੱਜ ਕੱਲ ਕੋ ਕੋਲੇਜ ਹਾਂਜੀ ਬਸ ਵਧੀਆ ਦੇਖ ਰਹੇ ਸੀਗੇ ਵੀ ਅੱਜ ਕੱਲ ਜਿਵੇਂ ਜਿਹੜੇ ਬੱਚੇ ਨੋਨ ਮੈਡੀਕਲ ਸਟਰੀਮ ਦੇ ਵਿੱਚ ਨੇ ਉਹ ਤਾਂ ਜ਼ਿਆਦਾਤਰ ਕੰਪਿਊਟਰ ਸਾਇੰਸ ਦੀ ਐਜੂਕੇਸ਼ਨ ਹੀ ਅੱਗੇ ਫਿਰ ਲੈਂਦੇ ਹਾਂਜੀ ਜਿਹੜੇ ਇਹਨਾਂ ਦੇ ਵਿੱਚ ਬੱਚਿਆਂ ਨੂੰ ਫਾਇਦਾ ਵੀ ਫਿਰ ਅੱਗੇ ਜਾ ਕੇ ਜ਼ਿਆਦਾ ਹੀ ਰਹਿੰਦਾ ਨਾ ਹਾਂਜੀ ਮੈਂ ਤਾਂ ਦੇਖ ਰਹੀ ਸੀਗੀ ਵੀ ਹਰ ਸਾਲ ਬੱਚੇ ਜੋ ਹੈ ਇਸ ਸਟਰੀਮ ਦੇ ਵਿੱਚ ਵੱਧਦੇ ਹੀ ਜਾਂਦੇ ਆ ਘੱਟ ਤਾਂ ਰਹੇ ਨਹੀਂ ਹਾਂ ਜੀ ਹਾਂਜੀ ਅੱਜ ਕੱਲ ਤਾਂ ਟੈਕਨੋਲਜੀ ਜਿੰਨੀ ਵੱਧ ਰਹੀ ਹੈ ਨਾ ਉਹ ਵੀ ਲੋੜ ਹੀ ਹੈ ਲੋਕਾਂ ਦੀ ਕਹਿ ਲਓ ਹੁਣ ਤਾਂ ਮੈਡੀਕਲ ਅਤੇ ਟੈਕਨੋਲਜੀ ਦੋਨੇ ਇੱਕ ਦੂਜੇ ਨਾਲ ਕੌਮਬਾਈਨ ਵੀ ਕਰਕੇ ਬਹੁਤ ਕੁਝ ਵਧੀਆ ਨਵਾਂ ਕਰ ਰਹੀਆਂ ਨੇ ਮੈਂ ਤਾਂ ਦੇਖ ਰਹੀ ਸੀਗੀ ਵੀ ਜਿੱਦਾਂ ਸਾਡੇ ਇਥੇ ਕੋਲੇਜ ਦੇ ਕੁਝ ਸਟੂਡੈਂਟਸ ਨੇ ਉਹਨਾਂ ਨੇ ਮਿਲ ਕੇ ਜਿੱਦਾਂ ਇੱਕ ਵੀਲ ਚੇਅਰ ਵੀ ਬਣਾਈ ਸੀਗੀ ਉਹਦੇ ਵਿੱਚ ਜਿੱਦਾਂ ਵੀ ਜਿਹੜੇ ਹੁੰਦੇ ਆ ਨਾ ਲੋਕ ਜਿਹੜੇ ਤੁਰ ਨਹੀਂ ਸਕਦੇ ਉਹ ਬਰੇਨ ਸਿਗਨਲ ਦੇ ਨਾਲ ਹੀ ਉਹ ਜਿਹੜੀ ਵੀਲ ਚੇਅਰ ਹੈ ਉਹ ਵਰਕ ਕਰਨ ਲੱਗ ਜਾਂਦੀ ਹੈ ਤਾਂ ਮੈਨੂੰ ਬਹੁਤ ਖੁਸ਼ੀ ਹੋਈ ਮਤਲਬ ਬੱਚਿਆਂ ਦਾ ਆਹ ਸਾਰਾ ਹੁਨਰ ਦੇਖ ਕੇ ਹਾਂਜੀ ਜਦੋਂ ਤੁਸੀਂ ਵੀ ਫਿਜਿਓਥਰੈਪੀ ਦੇ ਵਿੱਚ ਦੱਸਦੇ ਸੀਗੇ ਨਾ ਵੀ ਕਿੰਨੇ ਕੁ ਫਾਇਦੇ ਬਹੁਤ ਜ਼ਿਆਦਾ ਹੋਣ ਵਾਲੇ ਆਉਣ ਵਾਲੇ ਟਾਇਮ ਦੇ ਵਿੱਚ ਹਾਂਜੀ ਹਾਂਜੀ ਚਲੋ ਫ਼ਿਰ ਜੀ ਹਾਂਜੀ ਚਲੋ ਮਿਲਦੇ ਹਾਂ ਫਿਰ ਆਇਓ ਕਦੇ ਸਤਿ ਸ਼੍ਰੀ ਅਕਾਲ ਜੀ